ਇੱਕੀ ਜੁਲਾਈ ਦੋ ਹਜ਼ਾਰ ਚਾਰ ਬਾਈ ਜਨਵਰੀ ਦੋ ਹਜ਼ਾਰ ਤਿੰਨ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਪੱਚੀ ਦਸੰਬਰ ਉੱਨੀ ਸੌ ਬਿਆਸੀ